ਜਿਵੇਂ ਕਿ ਮੈਂ ਪੰਜਾਬੀ ਹੀ ਹਾਂ ਮੈਂ ਸ਼ੁਰੂ ਤੋਂ ਪੰਜਾਬ ਵਿੱਚ ਹੀ ਰਹੀ ਹਾਂ ਅਤੇ ਮੈਂ ਭਾਸ਼ਾ ਵੀ ਬੋਲਣੀ ਸਭ ਤੋਂ ਪਹਿਲਾਂ ਪੰਜਾਬੀ ਹੀ ਸਿੱਖੀ ਅਤੇ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬੀ ਹੀ ਬੋਲਦੀ ਆ ਰਹੀ ਹਾਂ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਅਤੇ ਪੰਜਾਬ ਦਾ ਇਤਿਹਾਸ ਸੱਭਿਆਚਾਰ ਬਹੁਤ ਹੀ ਅਲੱਗ ਹੈ ਅਤੇ ਪੰਜਾਬ ਦਾ ਸੱਭਿਆਚਾਰ ਬਹੁਤ ਜ਼ਿਆਦਾ ਅਲੱਗ ਹੈ ਪੰਜਾਬ ਦੇ ਲੋਕ ਆਪਣੇ ਸੱਭਿਆਚਾਰ ਆਪਣੀ ਪਹਿਚਾਣ ਨੂੰ ਬਹੁਤ ਹੀ ਪਿਆਰ ਨਾਲ਼ ਅਪਣਾਉਂਦੇ ਹਨ ਅਤੇ ਇਹਨੂੰ ਬਹੁਤ ਇੱਜਤ ਕਰਦੇ ਹਨ ਅਤੇ ਆਪਣੇ ਭਾਸ਼ਾ ਸੱਭਿਆਚਾਰ ਆਪਣੀ ਪਹਿਚਾਣ ਨੂੰ ਸਾਂਭ ਕੇ ਰੱਖਦੇ ਹਨ ਹੋਰਾਂ ਵਾਂਗੂੰ ਨਹੀਂ ਕੁਝ ਲੋਕ ਹੁੰਦੇ ਹਨ ਜਿਹੜੇ ਆਪਣੇ ਸੱਭਿਆਚਾਰ ਨੂੰ ਛੱਡ ਕੇ ਕਿਸੇ ਨੂੰ ਦੂਜੇ ਦਾ ਸੱਭਿਆਚਾਰ ਵਧੀਆ ਲੱਗਦਾ ਹੈ ਉਸਦੇ ਵਿੱਚ ਹੀ ਢੱਲ ਜਾਂਦੇ ਹਨ ਪੰਜਾਬੀ ਇੱਦਾਂ ਨਹੀਂ ਹੈ ਪੰਜਾਬੀ ਲੋਕ ਆਪਣੀ ਭਾਸ਼ਾ ਆਪਣਾ ਪਹਿਚਾਣ ਆਪਣਾ ਸੱਭਿਆਚਾਰ ਪੂਰੀ ਤਰ੍ਹਾਂ ਸੀਂਝ ਕੇ ਰੱਖਦੇ ਹਨ ਅਤੇ ਅਗਰ ਆਪਾਂ ਇੰਗਜਾਪ ਇੰਗਜਾਮਪਲ ਲਈਏ ਪੰਜਾਬੀ ਜਿੱਦਾਂ ਪੰਜਾਬੀ ਕਾਫ਼ੀ ਸਾਰੇ ਕੈਨੇਡਾ ਵਿੱਚ ਅਲੱਗ ਅਲੱਗ ਕੰਨਟਰੀਆਂ ਦੇ ਵਿੱਚ ਜਾ ਰਹੇ ਹੈ ਉੱਥੇ ਜਾ ਕੇ ਵੀ ਉਹਨਾਂ ਵਰਗੇ ਨਹੀਂ ਹੋ ਰਹੇ ਆਪਣੀ ਸੱਭਿਆਚਾਰ ਆਪਣੀ ਭਾਸ਼ਾ ਆਪਣੀ ਪਹਿਚਾਣ ਉਹ ਅਲੱਗ ਰੱਖ ਰਹੇ ਹਨ ਅਗਰ ਆਪਾਂ ਕਿਸੇ ਵੀ ਕਿਸੇ ਵੀ ਫੋਰਨ ਕੰਨਟਰੀ ਵਿੱਚ ਜਾਂਦੇ ਸਾਨੂੰ ਕੋਈ ਪੰਜਾਬੀ ਮਿਲੇਗਾ ਆਪਾਂ ਜਾ ਕੇ ਉਹਦੇ ਨਾਲ਼ ਗੱਲ ਕਰਾਂਗੇ ਉਹ ਸਾਡੇ ਨਾਲ਼ ਹਮੇਸ਼ਾਂ ਅੱਗੇ ਤੋਂ ਪੰਜਾਬੀ ਨਾਲ਼ ਹੀ ਗੱਲ ਕਰੇਗਾ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਵਧੀਆ ਖੁੱਲ੍ਹਿਆ ਅਤੇ ਪੰਜਾਬ ਦੇ ਲੋਕ ਬਹੁਤ ਬਹਾਦਰ ਬਹਾਦਰੀ ਵਾਲੇ ਹਨ ਅਤੇ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਚੱਜ ਨਾਲ਼ ਰੱਖਦੇ ਹਨ ਪੰਜਾਬ ਦਾ ਸੱਭਿਆਚਾਰ ਅਗ ਆਪਾਂ ਜਾ ਕੇ ਦੇਖਾਂਗੇ ਤਾਂ ਹਰ ਇੱਕ ਫੋਰਨ ਕੰਨਟਰੀ ਦੇ ਵਿੱਚ ਵੀ ਜੋ ਪੰਜਾਬ ਦੇ ਲੋਕ ਗਏ ਆ ਉਹਨਾਂ ਨੇ ਆਪਣੇ ਸੱਭਿਆਚਾਰ ਆਪਣਾ ਇਤਿਹਾਸ ਆਪਣਾ ਸ ਸ ਕਲਚਰ ਸਾਰਾ ਉੱਥੇ ਜਾ ਕੇ ਵੀ ਉੱਦਾਂ ਹੀ ਪ੍ਰਚੱਲਿਤ ਕਰ ਲਿੱਤਾ ਹੈ ਅਤੇ ਕਾਫ਼ੀ ਸਾਰੇ ਫੋਰਨ ਲੋਕ ਜੋ ਕਿ ਉਸ ਪੰਜਾਬ ਦੇ ਨਹੀਂ ਵੀ ਹਨ ਉਹ ਵੀ ਜਾ ਕੇ ਭਾਰਤ ਦੇ ਸੱਭਿਆਚਾਰ ਨੂੰ ਅਪਣਾ ਰਹੇ ਹਨ ਭਾਰਤ ਦੇ ਪੁਸ਼ਾਕ ਜੋ ਕਿ ਸਲਵਾਰ ਸੂਟ ਹੈ ਕੁੜੀਆਂ ਦੇ ਉਹਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਉਹ ਵੀ ਪਾਉਂਦੇ ਹਨ ਅਤੇ ਉਹਨਾਂ ਨੂੰ ਸ਼ੌਂਕ ਹੋ ਰਿਹਾ ਓ ਆਪ ਤਾਂ ਉਹ ਪੰਜਾਬੀ ਆਪਣੇ ਸੱਭਿਆਚਾਰ ਵਿੱਚ ਹੀ ਹੈ ਆਪਣੀ ਭਾਸ਼ਾ ਬੋਲਦੇ ਹਨ ਆਪਣੇ ਨਾਲ਼ ਨਾਲ਼ ਉਹ ਫੋਰਨ ਜਾਂ ਹੋਰ ਕੰਨਟਰੀ ਦੇ ਲੋਕਾਂ ਨੂੰ ਵੀ ਆਪਣੇ ਸੱਭਿਆਚਾਰ ਵਿੱਚ ਲੈ ਕੇ ਆ ਰਹੇ ਹੈ ਜਿਸ ਕਰਕੇ ਪੰਜਾਬ ਦੇ ਸੱਭਿਆਚਾਰ ਨੂੰ ਆਪਣੀ ਅਲੱਗ ਹੀ ਪਹਿਚਾਣ ਦੇ ਰਹੇ ਹੈ ਪੰਜਾਬੀ ਭਾਸ਼ਾ ਆਪਾਂ ਕਿਸੇ ਵੀ ਦੁਨੀਆਂ ਦੇ ਖੇਤਰ ਵਿੱਚ ਜਾ ਕੇ ਦੇਖ ਸਕਦੇ ਹਰ ਜਗ੍ਹਾ ਪੰਜਾਬੀ ਵਸ ਚੁੱਕੇ ਹਨ ਅਤੇ ਉਹ ਪੰਜਾਬੀ ਭਾਸ਼ਾ ਹੀ ਬੋਲ ਦੇ ਹਨ ਕਿਸੇ ਵੀ ਹੋਰ ਭਾਸ਼ਾ ਤੋਂ ਉੱਪਰ ਪੰਜਾਬੀ ਭਾਸ਼ਾ ਨੂੰ ਹੀ ਤਵੱਜੋ ਦਿੰਦੇ ਹਨ ਅਤੇ ਮਾਣ ਨਾਲ਼ ਆਪਣੀ ਪੰਜਾਬੀ ਭਾਸ਼ਾ ਬੋਲਦੇ ਹਨ